ਮੈਂ ਬਹੁਤ ਸਾਰੇ ਤੈਰਾਕੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਸਾਡੇ ਜ਼ਿਲ੍ਹੇ ਬਠਿੰਡੇ ਵਿੱਚ ਬਹੁਤ ਸਾਰੇ ਤੈਰਾਕੀ ਮੁਕਾਬਲੇ ਹੁੰਦੇ ਹਨ ਜਿਹਨਾਂ ਵਿੱਚ ਮੈਂ ਅਕਸਰ ਹੀ ਭਾਗ ਲੈਂਦਾ ਰਹਿੰਦਾ ਹਾਂ ਮੇਰਾ ਸਭ ਤੋਂ ਯਾਦਗਾਰੀ ਅਨੁਭਵ ਬਠਿੰਡਾ ਦੇ ਸਟੇਡੀਅਮ ਵਿੱਚ ਤੈਰਾਕੀ ਮੁਕਾਬਲਿਆਂ ਵਿੱਚ ਜਦ ਮੈਂ ਪਹਿਲੀ ਵਾਰ ਫਸਟ ਆਇਆ ਸੀ ਉਹ ਮੇਰੇ ਲਈ ਬਹੁਤ ਚੰਗਾ ਅਨੁਭਵ ਸੀ ਇਸ ਤਰ੍ਹਾਂ ਦੇ ਮੁਕਾਬਲੇ ਸਾਨੂੰ ਅੱਗੇ ਵਧਣ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦੇ ਹਨ ਮੇਰਾ ਬਚਪਨ ਤੋਂ ਹੀ ਤੈਰਾਕੀ ਵੱਲ

ਖਿੱਚ ਰਹੀ ਹੈ ਮੈਂ ਆਪਣੇ ਬਚਪਨ ਵਿੱਚ ਮਨੋਰੰਜਨ ਦੇ ਲਈ ਆਪਦੇ ਦੋਸਤਾਂ ਨਾਲ ਤੈਰਾਕੀ ਵਿੱਚ ਦੌੜ ਵਿੱਚ ਹਿੱਸਾ ਲੈਂਦਾ ਹੀ ਰਹਿੰਦਾ ਸੀ ਜਿਸ ਨਾਲ ਮੇਰੀ ਬਹੁਤ ਵਧੀਆ ਤਿਆਰੀ ਹੁੰਦੀ ਰਹਿੰਦੀ ਸੀ